ਤੁਹਾਡੇ ਦੁਆਰਾ ਡਾਊਨਲੋਡ ਕੀਤੀ ਗਈ ਆਖਰੀ ਐਪ ਮੇਰੇ ਦੁਆਰਾ ਆਖਰੀ ਐਪ ਤਾਂ ਇਹੀ ਸੀ ਇੱਕ ਇੰਗਲਿਸ਼ ਸਿੱਖਣ ਲਈ ਸੀਗੀ ਐਪ ਜਿਹਦੇ ਵਿੱਚ ਮੈਂ ਸਪੀਕਿੰਗ ਦਾ ਕੋਰਸ ਇੰਗਲਿਸ਼ ਸਪੀਕਿੰਗ ਦਾ ਕੋਰਸ ਕਿਉਂਕਿ ਮੇਰੀ ਇੰਗਲਿਸ਼ ਥੋੜ੍ਹੀ ਕੋਮਨੀਕੇਸ਼ਨ ਜਿਹੜੀ ਸਕਿਲਜ ਨੇ ਥੋੜ੍ਹੀ ਘੱਟ ਨੇ ਇਸ ਲੀਏ ਮੈਨੇ ਉਹੀ ਐਪ ਡਾਊਨਲੋਡ ਕਰੀ ਸੀ ਜ਼ਿਆਦਾਤਰ ਜਿਹੜੀ ਮੇਰੇ ਕੋਲ ਮੇਰੇ ਫੋਨ 'ਚ ਜਿਹੜੀ ਐਪ ਨੇ ਜ਼ਿਆਦਾਤਰ ਐਜੂਕੇਸ਼ਨਲ ਐਪ ਹੀ ਹੁੰਦੀਆਂ ਨੇ ਉਸ ਤੋਂ ਇਲਾਵਾ ਤਾਂ ਮੇਰੇ ਕੋਲ ਘੱਟ ਵੱਧ ਹੀ ਹੁੰਦੀਆਂ ਨੇ ਸ਼ੋਸ਼ਲ ਮੀਡੀਆ ਐਪ ਪਈਆਂ ਨੇ ਥੋੜ੍ਹੀਆਂ ਮੋਟੀਆਂ ਇੰਸਟਾਗ੍ਰਾਮ ਵਗੈਰਾ ਜ਼ਿਆਦਾਤਰ ਮੈਂ ਐਜੂਕੇਸ਼ਨਲ ਐਪ ਹੀ ਰੱਖਦਾ ਕਿਉਂਕਿ ਮੈਂ ਇੱਕ ਸਟੂਡੈਂਟ ਹਾਂ ਅਤੇ ਮੈਨ ਤਿਆਰੀ ਵਗੈਰਾ ਕਰਨੀ ਹੁੰਦੀ ਹੈ ਕੰਮ ਸਰਕਾਰੀ ਪੇਪਰਾਂ ਦੀ ਜਿਵੇਂ ਲੇਬਰ ਇੰਸਪੈਕਟਰ ਜਿਵੇਂ ਕਿ ਹੁਣ ਮੈਂ ਕਰਦਾ ਪਿਆਂ ਤਾਂ ਮੈਂ ਇਸ ਤੋਂ ਜ਼ਿਆਦਾ ਕੋਈ ਹੋਰ ਫਾਲਤੂ ਦੀ ਐਪ ਆਪਣੇ ਫੋਨ 'ਚ ਰੱਖਦਾ ਨਹੀਂ ਰੀਸੈਂਟ ਜਿਹੜੀ ਮੈਨੇ ਸਭ ਤੋਂ ਲਾਸਟ 'ਚ ਕਰੀ ਮੈਨੂੰ ਲੱਗਦਾ ਇੰਗਲਿਸ਼ ਸਪੀਕਿੰਗ ਸਿੱਖਣ ਲਈ ਹੀ ਮੈਨੇ ਕਰੀ ਹੈ ਹਾਲਾਂਕਿ ਉਹ ਮੈਂ ਯੂਜ ਬੜੀ ਘੱਟ ਕਰ ਰਿਹਾ ਕਿਉਂਕਿ ਮੇਰਾ ਇੱਕ ਇਗਜਾਮ ਹੈ ਤਾਂ ਇਗਜਾਮ ਕਰਕੇ ਮੈਨੂੰ ਥੋੜ੍ਹਾ ਟਾਈਮ ਨਹੀਂ ਮਿਲਦਾ ਉਸ ਐਪ ਨੂੰ ਯੂਜ ਕਰਨ ਦਾ ਬੱਟ ਹਾਂ ਜਦੋਂ ਮੈਂ ਫ੍ਰੀ ਹੋਊਂਗਾ ਮੈਨੂੰ ਪਤਾ ਕਿ ਮੈਂ ਜੋ ਜ਼ਰੂਰ ਯੂਜ ਕਰੂੰਗਾ ਉਸ ਐਪ ਨੂੰ ਅਤੇ ਹੋਰ ਬਸ ਆਹੀ ਹੈ